ਸਤਿ ਸ਼੍ਰੀ ਅਕਾਲ ਜੀ ਮੈਂ ਪੁਲਿਸ ਮਹਿਕਮੇ ਵਿੱਚ ਜੋਬ ਕਰਦੀ ਹਾਂ ਅਤੇ ਸਾਨੂੰ ਜੋਬ ਦੇ ਵਿੱਚ ਐਨ ਪੀ ਐਸ ਮਿਲਦਾ ਜੋ ਕਿ ਸਾਡੇ ਇੱਕ ਬੈਂਕ ਅਕਾਊਂਟ ਦੇ ਵਿੱਚ ਆਉਂਦਾ ਠੀਕ ਹੈ ਅਤੇ ਸਾਡੇ ਘਰ ਵਿੱਚ ਵਿਆਹ ਗਾ ਜਿਸ ਕਰਕੇ ਮੈਨੂੰ ਪੈਸਿਆਂ ਦੀ ਲੋੜ ਹੈ ਅਤੇ ਮੈਂ ਐਨ ਪੀ ਐਸ ਕਢਵਾਉਣਾ ਚਾਹੁੰਦੀ ਹਾਂ ਬਟ ਐਨ ਪੀ ਐਸ ਕਢਵਾਉਣ ਲਈ ਮੈਂ ਆਪਣੇ ਖਾਤੇ ਦਾ ਜਿਹੜਾ ਪਾਸਵਰਡ ਹੈ ਉਹ ਭੁੱਲ ਚੁੱਕੀ ਹਾਂ ਮੈਂ ਬਹੁਤ ਵਾਰ ਫਾਰਗਟ ਪਾਸਵਰਡ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਬਟ ਉਹ ਫਾਰਗਟ ਨਹੀਂ ਹੋ ਰਿਹਾ ਅਤੇ ਵਾਰੀ ਵਾਰੀ ਪਾਸਵਰਡ ਗਲਤ ਦੱਸ ਰਿਹਾ ਅਤੇ ਮੈਨੂੰ ਪਾਸਵਰਡ ਵੀ ਨਹੀਂ ਯਾਦ ਜਿਸ ਕਰਕੇ ਮੈਂ ਆਪਦਾ ਅਕਾਊਂਟ 'ਚੋਂ ਪੈਸੇ ਕਢਵਾ ਸਕਾਂ ਤਾਂ ਕੀ ਤੁਸੀਂ ਮੈਨੂੰ ਕਿਰਪਾ ਕਰਕੇ ਦੱਸ ਸਕਦੇ ਹੋ ਕਿ ਮੈਂ ਆਪਦਾ ਪਾਸਵਰਡ ਰੀਸੈਟ ਕਰਨ ਲਈ ਕਿੱਦਾਂ ਕਰ ਸਕਦੀ ਹਾਂ ਅਤੇ ਤਾਂ ਜੋ ਕਿ ਮੈਂ ਆਪਦੇ ਐਨ ਪੀ ਐਸ ਦੇ ਵਿੱਚੋਂ ਪੈਸੇ ਕਢਵਾ ਸਕਾਂ ਤਾਂ ਜੋ ਕਿ ਮੈਂ ਵਿਆਹ ਲਈ ਲੋੜੀਂਦੇ ਜਿੰਨੇ ਕੁ ਮੈਨੂੰ ਚਾਹੀਦੇ ਨੇ ਓਨੇ ਕੁ ਮੈਂ ਪੈਸੇ ਕਢਵਾ ਸਕਾਂ ਇਸ ਲਈ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿੱਦਾਂ ਕਰਕੇ ਤੁਸੀਂ ਮੈਨੂੰ ਉਹ ਕਰ ਸ ਮੈਂ ਪੈਸੇ ਕਢਵਾ ਸਕਦੀ ਹਾਂ ਅਧਾਰ ਅ ਕਾਰਡ ਦੀ ਆਪਸ਼ਨ ਨਾਲ ਲਿੰਕ ਕਰਕੇ ਅਤੇ ਮਤਲਬ ਡੇਟ ਆਫ ਬਰਥ ਕਰਕੇ ਅਤੇ ਉਹਦਾ ਪਾਸਵਰਡ ਫਾਰਗਟ ਕਰਕੇ ਮੈਂ ਕਢਵਾ ਸਕਦੀ ਹਾਂ ਠੀਕ ਹੈ ਜੀ ਧੰਨਵਾਦ